ਹੈਲੋ ਜੀ ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਹਾਂ ਵਧੀਆ ਵਧੀਆ ਹੋਰ ਕੀ ਚਲਦਾ ਏ ਹੈਲੋ ਜੀ ਹਾਂਜੀ ਬਸ ਮੈਂ ਤਾਂ ਅੱਜ ਉਹ ਸੋਚੀ ਜਾਂਦੀ ਸੀ ਕੁਝ ਲਿਖਣ ਦਾ ਅਤੇ ਮੈਂ ਸੋਚਿਆ ਤੁਹਾਨੂੰ ਫੋਨ ਲਾ ਦਿੱਤਾ ਜਾਵੇ ਕਰੋਨਾ ਉੱਤੇ ਲਿਖਣ ਦੀ ਸੋਚ ਰਹੀ ਸੀ ਅਤੇ ਮੈਂ ਸੋਚ ਰਹੀ ਸੀ ਉਹਦਾ ਫਿਰ ਰਾਈਟਿੰਗ ਪ੍ਰੋਸੈਸ ਕੀ ਰੱਖਿਆ ਜਾਵੇ ਅਤੇ ਮੈਂ ਸੋਚ ਰਹੀ ਸੀ ਇੱਕ ਬੁੱਕ ਆਪਾਂ ਜੇ ਲਿਖ ਦਿੱਤੀ ਜਾਵੇ ਕਿਉਂਕਿ ਕਰੋਨਾ ਦੋ ਸਾਲ ਰਿਹਾ ਹਾਂਜੀ ਹਾਂਜੀ ਕੋਵਿਡ ਦੋ ਸਾਲ ਰਿਹਾ ਸੀ ਅਤੇ ਇੱਕ ਸੋਹਣੀ ਜਿਹੀ ਬੁੱਕ ਲਿਖੀ ਜਾਵੇ ਉਹਦੇ 'ਤੇੇ ਤੁਹਾਡਾ ਕੀ ਖਿਆਲ ਹੈ ਤੁਸੀਂ ਕਿਹੜੇ ਕਿਹੜੇ ਪੁਆਇੰਟ ਵਿੱਚ ਇੰਕਲੂਡ ਕਰਨਾ ਚਾਹੋਗੇ ਉਹਦੇ 'ਚ ਨਹੀਂ ਸਹੀ ਗੱਲ ਹਾਂਜੀ ਹਾਂਜੀ ਬਸ ਮੈਂ ਵੀ ਇਹੀ ਸੋਚ ਰਹੀ ਸੀ ਹਾਂਜੀ ਜੇ ਆਪਾਂ ਰਾਈਟਿੰਗ ਪ੍ਰੋਸੈਸ ਐਵੇਂ ਹੀ ਰੱਖੀਏ ਕਿ ਪਹਿਲੇ ਥੋੜ੍ਹਾ ਜਿਹਾ ਸਟੋਰੀ ਲਾਈਨ ਲਿਖ ਦੇਈਏ ਉਸ ਤੋਂ ਬਾਅਦ ਥੋੜ੍ਹੇ ਇੰਟਰੋ ਦੇ ਕੇ ਇਕ ਇੰਸੀਡੈਂਟ ਦਿੰਦੇ ਹਾਂ ਕਰੋਨਾ ਬਾਰੇ ਨੈਗੇਟਿਵ ਵੀ ਫਿਰ ਪੋਜ਼ੀਟਿਵ ਵੀ ਉਸ ਤੋਂ ਬਾਅਦ ਇੱਕ ਮੋਰਾਲ ਦੇ ਕੇ ਬੱਚਿਆਂ ਵਾਸਤੇ ਕਿਤਾਬ ਲਿਖੀ ਜਾਵੇ ਜਿਹੜੇ ਅੱਜ ਕੱਲ੍ਹ ਦੇ ਕਰੋਨਾ ਤੋਂ ਬਾਅਦ ਵਾਲੇ ਚੱਲੇ ਨੇ ਹਾਂਜੀ ਹਾਂਜੀ ਨਹੀਂ ਨਹੀਂ ਇਕਦਮ ਸਹੀ ਗੱਲ ਏ ਜੀ ਤੁਹਾਡੀ ਇਕਦਮ ਵਧੀਆ ਮੈਂ ਵੀ ਆਹੀ ਸੋਚ ਰਹੀ ਸੀ ਅਤੇ ਬਹੁਤ ਹੀ ਇਫੈਕਟਿਵ ਟੋਪਿਕ ਹੈ ਇਹਦੇ 'ਤੇ ਆਪਾਂ ਨੂੰ ਲਿਖਣਾ ਚਾਹੀਦਾ ਹਾਲੇ ਤੱਕ ਮੇਰੇ ਖਿਆਲ ਨਾਲ ਕਾਫੀ ਰਾਈਟਰਸ ਨੇ ਲਿਖਿਆ ਪਰ ਬੱਚਿਆਂ ਦੇ ਵਾਸਤੇ ਆਪਣੇ ਅੱਜ ਕੱਲ੍ਹ ਦੇ ਸਕੂਲ ਦੇ ਜਿਹੜੇ ਬੱਚੇ ਨੇ ਛੋਟੀ ਕਲਾਸ ਵਾਲੇ ਭਾਵੇਂ ਉਹ ਵੱਡੀਆਂ ਕਲਾਸਾਂ ਦੇ ਦੋ ਸਾਲ ਜੋ ਹੁਣ ਅੱਠਵੀਂ ਦੇ ਜਵਾਕ ਸੀ ਉਹ ਦਸਵੀਂ 'ਚ ਆ ਗਏ ਸੀ ਉਹਨਾਂ ਸਾਰਿਆਂ ਦੀ ਚੀਜ਼ਾਂ ਨੂੰ ਆਪਾਂ ਨੂੰ ਸਮਰਾਈਜ ਕਰਕੇ ਹਰ ਚੀਜ਼ ਨੂੰ ਮੈਡੀਕਲ ਇਸ਼ੂ ਜਿੰਨੇ ਹੋਏ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਾਂ ਜੀ ਇਕੱਠੇ ਲਿਖ ਲਾਂਗੇ ਹਾਂਜੀ ਓਕੇ ਜੀ